ਹਾਂਜੀ ਹੁਣ ਤੁਸੀਂ ਆ ਤਾਂ ਗਏ ਹੀ ਹੋ ਚੱਲੋ ਹੁਣ ਤੁਹਾਨੂੰ ਘਰ ਵਿਖਾ ਦਿੰਦੇ ਹਾਂ ਹਾਂਜੀ ਅੰਦਰ ਆ ਜਾਓ ਚਲ ਆਓ ਤੇ ਵੀਰੇ ਤੁਹਾਨੂੰ ਕੱਟ ਆਊਟ ਤੋਂ ਘਰ ਵਿਖਾ ਦਿੰਦੇ ਹਾਂ ਹਾਂਜੀ ਵੀਰੇ ਆਹ ਆਪਾਂ ਕੱਟ ਆਊਟ 'ਤੇ ਆ ਗਏ ਹਾਂ ਜੀ ਇੱਥੇ ਆਪਾਂ ਨੂੰ ਫੈਸਲਿਟੀ ਹੈਗੀ ਹੈ ਜੀ ਇੱਥੇ ਬਾਏ ਚਾਰ ਬਾਏ ਚਾਰ ਚਾਰ ਬਾਏ ਪੰਦਰਾਂ ਦਾ ਈਕ ਆ ਜੀ ਏਰੀਆ ਇੱਥੋਂ ਆਪਾਂ ਕਰ ਸਕਦੇ ਹਾਂ ਜੀ ਵੀਰੇ ਇੱਥੇ ਵੋਸ਼ਿੰਗ ਮਸ਼ੀਨ ਰੱਖ ਸਕਦੇ ਹਾਂ ਜੀ ਇੱਥੇ ਹੋਰ ਵੀ ਆਪਾਂ ਸਮਾਨ ਰੱਖ ਸਕਦੇ ਹਾਂ ਜੋ ਵੀ ਆਪਣਾ ਸਮਾਨ ਹੁੰਦਾ ਹੈ ਘਰ ਦਾ ਹਾਂਜੀ ਵੀਰੇ ਮੇਨ ਗੇਟ ਤਾਂ ਆਪਾਂ ਜੀ ਵੀਰੇ ਇੱਕ ਤਾਂ ਉਹ ਹੁੰਦਾ ਜੀ ਲੋਇਆ ਹੁੰਦਾ ਹਾਂਜੀ ਉਸ ਨੂੰ ਵੀਰੇ ਜੰਗ ਬਹੁਤ ਜ਼ਿਆਦਾ ਜਲਦੀ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਸਟੀਲ ਦਾ ਗੇਟ ਲਗਵਾਇਆ ਇੱਕ ਤਾਂ ਇਹ ਹੈਵੀ ਹੈ ਇੱਕ ਦੂਜਾ ਸਲਾਈਡਿੰਗ ਵਾਲਾ ਵੀਰੇ ਨੋਰਮਲ ਓਪਨ ਕਲੋਜ਼ ਵਾਲਾ ਨਹੀਂ ਹੈਗਾ ਇਹ ਸਲਾਈਡਿੰਗ ਵਾਲਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਜਗ੍ਹਾ ਘੱਟ ਘੇਰਦਾ ਕੱਲ੍ਹ ਨੂੰ ਜੇ ਆਪਾਂ ਸਲਾਈਡ ਕਰਕੇ ਵਧੀਆ ਕਰਨਾ ਹੋਵੇ ਤਾਂ ਤਾਂ ਮਤਲਬ ਨੁਕਸਾਨ ਨਹੀਂ ਹੈਗਾ ਇਹਦੇ ਫਾਇਦੇ ਹੀ ਨੇ ਗਾਰਡਨ ਵੀਰੇ ਗਾਰਡਨ ਹੈਗਾ ਅੱਠ ਬਾਏ ਦਸ ਦਾ ਏਰੀਆ ਹੈ ਇਹਦੇ ਵਿੱਚ ਵੈਸੇ ਤਾਂ ਆਪਾਂ ਨੋਰਮਲ ਬੈਠ ਸਕਦੇ ਹਾਂ ਕੁਰਸੀਆਂ ਕੁਰਸੀਆਂ ਡਾਹ ਲਾ ਸਕਦੇ ਹਾਂ ਬਸ ਵੈਸੇ ਇਹਦੇ ਵਿੱਚ ਥੋੜ੍ਹਾ ਮੋਟਾ ਆਪਾਂ ਗਮਲੇ ਗੁਮਲੇ ਰੱਖ ਕੇ ਥੋੜ੍ਹਾ ਮੋਟਾ ਬੈਠ ਬੂਠ ਸਕਦੇ ਹਾਂ ਇਹਦੇ ਵਿੱਚ ਆਪਾਂ ਇੱਕ ਫੁਹਾਰਾ ਵੀ ਲਗਾਇਆ ਹੋਇਆ ਜਿਹਦੇ ਨਾਲ ਗਰਾਸ ਨੂੰ ਮਤਲਬ ਘਾਹ ਨੂੰ ਪਾਣੀ ਪੁਣੀ ਮਿਲਦਾ ਰਹੇ ਉਹਦੇ ਨਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਵਧੀਆ ਕੰਮ ਕਰਵਾਇਆ ਅੰਡਰਗਰਾਊਂਡ ਫੁਹਾਰਾ ਲਗਵਾਇਆ ਇਸ 'ਚ ਆਪਾਂ ਨੂੰ ਕੋਈ ਸ਼ਿਕਇਤ ਨਹੀਂ ਆਵੇਗੀ ਹਾਂਜੀ ਹਾਂਜੀ ਹਾਂਜੀ ਚੱਲੋ ਚੱਲੋ ਅੰਦਰ ਜਾ ਕੇ ਦੇਖਦੇੇ ਹਾਂ ਹਾਂਜੀ ਹਾਂਜੀ ਡਰਾਇੰਗ ਰੂਮ ਵਿੱਚ ਵੀਰੇ ਡਰਾਇੰਗ ਰੂਮ ਹ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਦਸ ਬਾਏ ਦਸ ਦਾ ਏਰੀਆ ਇਹਦੇ ਵਿੱਚ ਆਪਾਂ ਸੋਫੇ ਲਗਾ ਸਕਦੇ ਹਾਂ ਜੀ ਇੱਕ ਮੇਜ਼ ਲਗਾ ਸਕਦੇ ਹਾਂ ਇੱਕ ਦਵਾਨ ਲਗਾ ਸਕਦੇ ਹਾਂ ਦੀਵਾਨ ਦੇ ਇਹਦੇ ਫਾਇਦੇ ਇਹ ਹੈ ਕਿ ਇੱਥੇ ਕਿਸੇ ਦੀ ਵਿੰਡੋ ਹੈ ਕਿ ਆਪਾਂ ਬਾਹਰ ਦਾ ਵਿਊ ਵੀ ਦੇਖ ਸਕਦੇ ਹਾਂ ਇੱਥੇ ਕੋਲ ਫੁੱਲ ਰੋਸ਼ਨੀ ਆਵੇਗੀ ਵੈਸੇ ਤਾਂ ਇੰਨੀ ਇਹ ਵੇਖੋ ਕਿ ਡਾਊਨ ਸਲਿੰਗ ਹੈ ਡਾਊਨ ਸੀਲਿੰਗ ਨਾਲ ਇੱਕ ਰੋਇਲ ਲਾਈਫ ਰੋਇਲ ਵਾਈਬ ਆ ਰਹੀ ਹੈ ਨਾਲ ਕੋਫਰ ਲੱਗੀ ਹੋਈ ਹੈ ਹਰ ਥਾਂ 'ਤੇ ਲਾਈਟਿੰਗ ਲੱਗੀ ਹੈ ਪੋਟਸ ਦਿੱਤੇ ਹੋਏ ਹੈ ਹਾਂਜੀ ਹਾਂਜੀ ਚਾਰ ਪੋਟਸ ਦਿੱਤੇ ਹੋਏ ਆ ਇਹਦੇ ਆਪਾਂ ਮਤਲਬ ਇੱਥੇ ਚਾਰਜਿੰਗ ਲਗਾ ਸਕਦੇ ਹਾਂ ਪਾਵਰ ਸਟੋਰਡ ਦਿੱਤੀ ਹੋਈ ਹੈ ਬਾਕੀ ਪਲੰਬਰ ਦਾ ਪਲੰਬਰ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਇਲੈਕਟ੍ਰੀਸ਼ਨ ਦਾ ਕੰਮ ਵੀ ਫੈਨ ਵੀ ਲੱਗਾ ਹੋਇਆ ਸਾਰਾ ਕੁਛ ਵਧੀਆ ਹੋਇਆ ਵੀਰੇ ਵੀਰੇ ਜਦੋਂ ਕੋਠੀ ਬਣਦੀ ਹੈ ਇਲੈਕਟ੍ਰੀਸ਼ਨ ਦਾ ਕੰਮ ਤਾਂ ਉਦੋਂ ਹੀ ਸਟਾਰਟ ਹੋ ਜਾਂਦਾ ਹੈ ਬਾਕੀ ਇਹਦੀ ਕੁਆਲਿਟੀ 'ਤੇ ਡਿਪੈਂਡ ਹੁੰਦਾ ਕਿ ਆਪਾਂ ਤਾਰ ਕਿਵੇਂ ਦੀ ਪਵਾ ਰਹੇ ਹਾਂ ਜਾਂ ਇਹਦਾ ਇਹ ਤਿਆਰੀ ਕਿਵੇਂ ਦੀ ਕਰਵਾ ਰਹੇ ਹਾਂ ਜਾਂ ਇਲੈਕਟ੍ਰੀਸ਼ਨ ਤੋਂ ਕੰਮ ਕਿਵੇਂ ਦਾ ਕਰਵਾ ਰਹੇ ਹਾਂ ਉਸ ਦੇ ਹਿਸਾਬ ਨਾਲ ਵੀਰੇ ਹੁੰਦੇ ਏ ਇਲੈਕਟ੍ਰੀਸ਼ਨ ਦੇ ਕੰਮ ਤੇ ਕੰਮ 'ਤੇ ਹੁੰਦਾ ਹੈ ਜਿਵੇਂ ਕਿ ਆਪਾਂ ਉਸ ਨੂੰ ਕਿੰਨੀ ਪੇਮੈਂਟ ਕਰ ਰਹੇ ਹਾਂ ਕਿਸ ਟਾਈਪ ਦਾ ਸਮਾਨ ਬਣਵਾ ਰਹੇ ਹਾਂ ਅਤੇ ਕੁਆਲਿਟੀ 'ਤੇ ਡਿਪੈਂਡ ਹੁੰਦਾ ਵੀਰੇ ਇਹਦੀ ਕੋਈ ਲਾਈਫ ਨਹੀਂ ਹੁੰਦੀ ਇਸ ਕਰਕੇ ਇਹ ਚੱਲਦਾ ਰਹੇ ਤਾਂ ਵਧੀਆ ਰਹਿੰਦਾ ਜੇ ਨਾ ਚੱਲੇ ਤਾਂ ਖ਼ਰਾਬ ਹੋ ਜਾਂਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਆ ਵੀਰੇ ਆ ਵੇਖੋ ਆਹ ਤੁਹਾਡੇ ਸਾਹਮਣੇ ਹੋਲ ਹੈ ਇਹ ਹੋਲ ਤਾਂ ਤੁਹਾਡੇ ਸਾਹਮਣੇ ਜਿੰਨਾ ਏਰੀਆ ਹੈਗਾ ਉਸਦੇ ਐਕੋਰਡਿੰਗ ਕਵਰ ਕੀਤਾ ਹੈ ਹੋਲ ਦੇ ਨਾਲ ਹੀ ਸਾਰਾ ਕੁਛ ਫਿਕਸ ਹੈ ਜਿਵੇਂ ਡਰਾਇੰਗ ਰੂਮ ਹੋ ਗਿਆ ਦੋ ਬੈਡ ਦੋ ਬੈਡਰੂਮ ਹੋ ਗਏ ਨਾਲ ਕਿਚਨ ਹੋ ਗਿਆ ਬਾਹਰ ਦਾ ਏਰੀਆ ਹੋ ਗਿਆ ਤੁਸੀਂ ਦੇਖੋ ਹੋਲ ਪੂਰਾ ਖੁੱਲ੍ਹਾ ਹੈ ਨਾਲ ਹੀ ਸਟੇਅਰਸ ਜਾਂਦੀਆਂ ਨੇ ਪੌੜੀਆਂ ਜਾਂਦੀਆਂ ਨੇ ਪੌੜੀਆਂ ਤਾਂ ਵੇਖੋ ਵੀਰੇ ਪੂਰੀ ਮਾਰਬਲ ਫਿਨਿਸ਼ਿੰਗ ਕੀਤੀ ਹੈ ਕੋਈ ਆਪਾਂ ਟਾਈਲ ਵਾਲਾ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਹਾਂਜੀ ਹਾਂਜੀ ਮਾਰਬਲ ਦਾ ਪੂਰਾ ਫਿਨਿਸ਼ ਹਾਂਜੀ ਹਾਂਜੀ ਵੀਰੇ ਕਿ ਇਹ ਹੈ ਕਿ ਕਿਚਨ ਵੇਖੋ ਤੁਹਾਡੇ ਸਾਹਮਣੇ ਸਭ ਕੁਛ ਵਧੀਆ ਕੀਤਾ ਹੈ ਹਾਂਜੀ ਮਾਰਬਲ ਦਾ ਫਿਨਿਸ਼ਿੰਗ ਕੀਤੀ ਹੈ ਟਾਇਲ ਲਿਤੀ ਹੋਈ ਹੈ ਨਾਲ ਡਵੇਟਰ ਲੱਗਾ ਹੋਇਆ ਅਤੇ ਉੱਤੇ ਪਾਣੀ ਦੀ ਟੂਟੀ ਦੀ ਫੈਸਲਿਟੀ ਹੈਗੀ ਹੈ ਡਰੋਰ ਦੇ ਉੱਤੇ ਇਹ ਭਾਂਡੇ ਰੱਖਣ ਵਾਸਤੇ ਗੈਸ ਵਾਸਤੇ ਸਭ ਕੁਛ ਫੈਸਲਿਟੀ ਹੈਗੀ ਹੈ ਮਲਤਬ ਤੁਹਾਡੇ ਸਾਹਮਣੇ ਕਿ ਇੱਥੇ ਲੱਕੜ ਵੀ ਬਹੁਤ ਵਧੀਆ ਲੱਗੀ ਹੋਈ ਹੈ ਕਿ ਤਾਂ ਕੱਲ੍ਹ ਨੂੰ ਸਿਊਂਕ ਵੀ ਨਾ ਲੱਗੇ ਪੂਰੀ ਚੰਗੀ ਤਰ੍ਹਾਂ ਮਜਬੂਤੀ ਨਾਲ ਲੱਗੇ ਹੋਏ ਆ ਕੰਧਾਂ ਵੀ ਪੂਰੀਆਂ ਮਜਬੂਤ ਨੇ ਕੱਲ੍ਹ ਨੂੰ ਕਿ ਸਿਲਾਬ ਵੀ ਨਾ ਆ ਸਕੇ ਕੰਧ ਦੇ ਵਿੱਚ ਤਾਂ ਜੋ ਪਲੰਬਰ ਦਾ ਕੰਮ ਵੀ ਐਡਾ ਵਧੀਆ ਹੋਇਆ ਹੈਗਾ ਕਿ ਕੱਲ੍ਹ ਨੂੰ ਕੋਈ ਪਾਈਪ ਵੀ ਲੀਕ ਹੋਈ ਨਾ ਤਾਂ ਆਪਣੀ ਜ਼ਿੰਮੇਵਾਰੀ ਹੈ ਵੀਰੇ ਹਾਂਜੀ ਹਾਂਜੀ ਵੀਰੇ